ਹਾਂਜੀ ਰੌਸ਼ਨੀ ਦੇ ਵਿੱਚ ਫੋਟੋਆਂ ਬਹੁਤ ਸੋਹਣੀਆਂ ਆਉਂਦੀਆਂ ਨੇ ਉਸ ਟਾਈਮ ਸਾਨੂੰ ਜ਼ਿਆਦਾ ਸ਼ੂਟਿੰਗ ਕਰਨ ਦੇ ਵਿੱਚ ਫੋਟੋ ਖਿੱਚਣ ਵਿੱਚ ਜ਼ਿਆਦਾ ਮਜ਼ਾ ਆਉਂਦਾ ਜਿੰਨੀ ਵੱਧ ਰੌਸ਼ਨੀ ਹੋਵੇਗੀ ਓਸ ਉਨੀ ਹੀ ਵਧੀਆ ਕਲੈਰਿਟੀ ਫੋਟੋ ਦੀ ਸ਼ੂਟਿੰਗ ਦੇ ਵਿੱਚ ਆਉਂਦੀ ਹੈ ਜਿਹੜੀਆਂ ਰੌਸ਼ਨੀ ਦੀਆਂ ਅਲੱਗ ਅਲੱਗ ਰੌਸ਼ਨੀ ਦੀ ਫੋਟੋਆਂ ਹੁੰਦੀਆਂ ਨੇ ਉਹਦੇ ਵਿੱਚ ਵਧੀਆ ਮਤਲਬ ਸੋਹਣੀਆਂ ਲੱਗਦੀਆਂ ਨੇ ਉਹਨਾਂ ਦੇ ਪੋਜ ਵੀ ਵਧੀਆ ਬਣਦੇ ਨੇ ਸੋਹਣੇ ਸੋਹਣੇ ਮਤਲਬ ਦੇਖਣ ਨੂੰ ਫੋਟੋਆਂ ਬਹੁਤ ਵਧੀਆ ਲੱਗਦੀਆਂ ਹਨ ਕਿ ਅਸੀਂ ਸੋਚਦੇ ਹਾਂ ਕਿ ਫੋਟੋ ਇੱਦਾਂ ਦੇ ਵੱਡੇ ਲਾਈਟਾਂ ਲਾ ਕੇ ਖੁੱਲ੍ਹੇ ਮਾਹੌਲ ਦੇ ਵਿੱਚ ਖੇਡੀਆਂ ਜ ਜਿੰਨਾ ਖੁੱਲ੍ਹੇ ਮਾਹੌਲ ਵਿੱਚ ਫੋਟੋ ਖਿੱਚੀ ਜਾਵੇਗੀ ਉਨੀ ਹੀ ਵਧੀਆ ਮਾਹੌਲ ਬਣੇਗਾ ਸਿੰਨਰੀ ਬਣਦੀ ਹੈ ਜੋ ਕਿ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਹੈ ਰੌਸ਼ਨੀ ਦੇ ਮੂਡ ਮਾਹੌਲ ਨੂੰ ਕਿਵੇਂ ਰੌਸ਼ਨੀ ਦੇ ਮਾਹੌਲ ਦੇ ਵਿੱਚ ਮੂਡ ਦੇਖਣ ਨੂੰ ਸੋਹਣੀ ਲੱਗਦੀ ਹੈ ਅਤੇ ਥੋੜ੍ਹੀ ਦਿਖ ਆਪਣੇ ਆਪ ਖੁਸ਼ ਹੋ ਜਾਂਦਾ ਵੀ ਵਾਹ ਕਿੰਨੀ ਸੋਹਣੀ ਫੋਟੋ ਆਈ ਆ ਬੰਦ ਬੰਦੇ ਨੂੰ ਦੇਖ ਕੇ ਆਪਣੇ ਆਪ ਖੁਸ਼ੀ ਮਹਿਸੂਸ ਹੋਣ ਲੱਗ ਜਾਂਦੀ ਆ ਜਿੰਨੀ ਜ਼ਿਆਦਾ ਰੌਸ਼ਨੀ ਹੋਵੇਗੀ ਉਨੀ ਕਲੈਰਟੀ ਫੋਟੋ ਦੇ ਵਿੱਚ ਆਉਗੀ ਜੋ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਇਸੇ ਤਰ੍ਹਾਂ ਜਿਹੜਾ ਖੁੱਲ੍ਹਾ ਮਾਹੌਲ ਹੈ ਉਹਨੂੰ ਉਹਦੇ ਵਿੱਚ ਹੀ ਸ਼ੂਟਿੰਗਾਂ ਵਗੈਰਾ ਕੀਤੀਆਂ ਜਾਂਦੀਆਂ ਨੇ